ਬਈ ਮੈਨੂੰ ਤਾਂ ਜਿੱਦਨ ਦਾ ਮੋਬਾਈਲ ਹੱਥ 'ਚ ਆਇਆ ਕੈਮਰਾ ਹਰ ਵੇਲੇ ਪਾਸ ਰਹਿੰਦਾ ਪਹਿਲਾਂ ਵੀ ਸ਼ੌਕ ਸੀ ਕੈਮਰੇ ਖਰੀਦਦੇ ਸੀ ਅਲੱਗ ਉਹ ਬਲੈਕ ਐਂਡ ਵਾਈਟ ਤੋਂ ਅਸੀਂ ਰੀਲਾਂ ਪਵਾ ਪਵਾ ਕੇ ਸ਼ੁਰੂ ਕੀਤਾ ਹੋਇਆ ਕੰਮ ਫਿਰ ਬਾਅਦ 'ਚ ਕਲਰਡ ਫੋਟੋਆਂ ਆ ਗਈਆਂ ਹੁਣ ਤਾਂ ਮੋਬਾਈਲ 'ਚ ਕਲਰਡ ਹਰ ਵਕਤ ਲਾਈਵ ਚਾਹੇ ਵੀਡੀਓ ਬਣਾ ਲਓ ਚਾਹੇ ਫੋਟੋ ਖਿੱਚ ਲਓ ਚਾਹੇ ਸਟਿਲ ਬਣਾ ਲਓ ਚਾਹੇ ਮੂਵੀ ਬਣਾ ਲਓ ਅਤੇ ਮੋਬਾਈਲ ਦੇ ਆਉਣ ਨਾਲ ਸਾਡੇ ਇਹ ਸ਼ੌਕ ਤਕਰੀਬਨ ਹੁਣ ਮੈਂ ਤਾਂ ਦੇਖਦਾ ਸਾਰੇ ਲੋਕ ਏ ਬਜ਼ੁਰਗ ਵੀ ਬਣੇ ਫਿਰਦੇ ਨੇ ਫ਼ੋਟੋਗਰਾਫਰ ਉਹ ਵੀ ਜਦ ਕਿਤੇ ਕੋਈ ਸੀਨ ਦੇਖਦੇ ਹੈ ਵਧੀਆ ਗੱਡੀ 'ਚ ਬੈਠੇ ਬੈਠੇ ਵੀ ਫੋਟੋ ਕਲਿਕ ਕਰ ਲੈਂਦੇ ਹੈ ਜਦ ਜਾ ਰਹੇ ਹੈ ਆਪਣੀ ਵੀਡੀਓ ਬਣਾਈ ਜਾ ਰਹੇ ਹੈ ਰਸਤੇ ਦੀ ਪੂਰੀ ਪੂਰੀ ਵੀ ਮੈਂ ਕਿੱਥੇ ਕਿੱਥੇ ਕਿਹੜੇ ਕਿਹੜੇ ਸੀਨਾਂ ਵਿੱਚੋਂ ਆਪਣੇ ਨਜ਼ਾਰਿਆਂ ਵਿੱਚੋਂ ਗੁਜ਼ਰ ਰਿਹਾ ਤਾਂ ਇਹ ਜਿਹੜਾ ਕੈਮਰਾ ਸੀ ਮੋਬਾਈਲ ਦੇ ਵਿੱਚ ਆਉਣ ਨਾਲ ਸਾਰਿਆਂ ਦਾ ਹਰਮਨ ਪਿਆਰਾ ਹੋ ਗਿਆ ਹੁਣ ਬਰਡੇ ਮਨਾਉਂਦੇ ਪਿੱਛੇ ਤੋਂ ਹੈ ਜਦੇ ਫੇਸਬੁਕ 'ਤੇ ਪਾਉ ਬਰਾਊਜ਼ਰ 'ਤੇ ਪਾਉ ਇੰਸਟਾਗਰਾਮ 'ਤੇ ਪਾਉ ਘਰ ਬੈਠੇ ਬਿਠਾਏ ਦੁਨੀਆਂ ਦੇ ਵਿੱਚ ਆਪਣੀਆਂ ਫੋਟੋਆਂ ਆਪਣੇ ਬੱਚੇ ਦੀਆਂ ਫੋਟੋਆਂ ਆਪਣੇ ਬੱਚੇ ਦੀ ਹਰ ਹਰਕਤ ਇੱਕ ਛੋਟੀ ਤੋਂ ਛੋਟੀ ਜਿਸ ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਹੈ ਅੱਜ ਕੱਲ੍ਹ ਉਹ ਸਾਡੇ ਸਾਹਮਣੇ ਆ ਰਹੀਆਂ ਹਨ ਔਰ ਅਸੀਂ ਉਹਨਾਂ ਨੂੰ ਇੰਜੋਏ ਕਰਦੇ ਹੈ